ਜਦੋਂ ਗੱਲ ਹੁੰਦੀ ਹੈ ਹਾਈਕ 'ਤੇ ਜਾਣ ਦੀ ਤਾਂ ਮੈਨੂੰ ਵੀ ਜੰਗਲਾਂ ਅਤੇ ਬੀਚਾਂ 'ਤੇ ਜਾਣਾ ਬਹੁਤ ਪਸੰਦ ਹੈ ਇਸ 'ਤੇ ਇਹਨਾਂ 'ਤੇ ਲੱਗੇ ਰੁੱਖਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਅਤੇ ਇਹ ਸਾਰੀਆਂ ਥਾਵਾਂ 'ਤੇ ਹੁੰਦੇ ਨੇ ਜਿੱਥੇ ਮੈਂ ਆਪਣੇ ਆਪ ਨੂੰ ਸ਼ਾਂਤੀ ਅਤੇ ਸੁੱਖ ਦੀ ਤਲਾਸ਼ ਵਿੱਚ ਮਹਿਸੂਸ ਕਰਦੀ ਹਾਂ ਹਵਾ ਵਿੱਚ ਚੱਲਣ ਦੇ ਦੌਰਾਨ ਹਿੱਲਜ਼ ਅਤੇ ਪਹਾੜਾਂ 'ਤੇ ਖੇਡਣ ਦਾ ਅਨੁਭਵ ਮੈਨੂੰ ਵਿਚਾਰਾਂ ਵਿੱਚ ਘੁੰਮਾਉਂਦਾ ਹੈ ਉੱਥੇ ਦੀ ਦ੍ਰਿਸ਼ਟੀਆਂ ਦੇ ਮੰਜ਼ਰ ਨੂੰ ਦੇਖਦੇ ਹੋਏ ਮੈਨੂੰ ਇਹ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੇ ਆਪ ਨੂੰ ਪ੍ਰਕਿਰਿਆਵਾਦੀ 'ਤੇ ਸਾਂਝਾ ਕਰ ਰਹੀ ਹਾਂ ਬਰਫੀਲੇ ਪਹਾੜਾਂ ਦੀ ਖੇਡ ਵੀ ਮੇਰੇ ਦਿਲ ਨੂੰ ਛੂਹ ਜਾਂਦੀ ਹੈ ਉਹਨਾਂ ਉੱਚੇ ਉੱਚੇ ਪਹਾੜਾਂ 'ਤੇ ਚੜ੍ਹਨ ਦਾ ਅਨੁਭਵ ਕੁਝ ਹੋਰ ਹੀ ਹੈ ਜਿੱਥੇ ਸੀਮਾਵਾਦੀ ਦੁਨੀਆ ਦਾ ਅਭਿਆਸ ਹੁੰਦਾ ਹੈ ਘਣੇ ਘਣੇ ਜੰਗਲ ਅਤੇ ਰੁੱਖ ਵੀ ਮੇਰੀ ਤਲਾਸ਼ ਦਾ ਹਿੱਸਾ ਹਨ ਝਰਨਿਆਂ ਦੀ ਸ਼ਾਂਤੀ ਅਤੇ ਉਹਨਾਂ ਦੇ ਚਿ ਛਿੱਟੇ ਮੇਰੇ ਮਨ ਨੂੰ ਮੋਹ ਲੈਂਦੇ ਨੇ ਸਾਰਾ ਦਿਨ ਕੰਮ ਕਾਜਾਂ ਦੇ ਬਾਅਦ ਸੋਹਣੇ ਸੱਜਦੇ ਸੂਰਜ ਦੀ ਛਾਂ ਸਾਨੂੰ ਮਹਿਸੂਸ ਕਰਵਾਉਂਦੀ ਹੈ ਕਿ ਉਹ ਇੱਕ ਅਨੋਖਾ ਅਨੁਭਵ ਦਾ ਹਿੱਸਾ ਹੈ ਅਤੇ ਮਨ ਨੂੰ ਸੁੱਖ ਪ੍ਰਦਾਨ ਕਰਦੀ ਹੈ